ਗਰਮੀ ਬੜੀ ਹੋ ਗਈ ਸੀ ਅਤੇ ਮੈਂ ਸੋਚਿਆ ਕੁਛ ਕੱਪੜੇ ਮੰਗਵਾਵਾ ਕੁਛ ਕੁੜਤੇਸ ਅਤੇ ਮੈਂ ਪਹਿਲਾਂ ਤਾਂ ਬਾਜ਼ਾਰ ਗਈ ਬਾਜ਼ਾਰ 'ਚ ਮੈਂ ਦੇਖਿਆ ਮੈਨੂੰ ਕੁਛ ਪਸੰਦ ਨਹੀਂ ਆਇਆ ਬਿਲਕੁਲ ਹੀ ਪਸੰਦ ਨਹੀਂ ਆਇਆ ਫਿਰ ਮੈਂ ਸੋਚਿਆ ਚਲੋ ਕੋਈ ਨਾ ਔਨਲਾਈਨ ਮੰਗਵਾ ਲੂੰਗੀ ਅਤੇ ਫਿਰ ਮੈਂ ਔਨਲਾਈਨ ਦੇਖੇ ਔਨਲਾਈਨ ਮੈਨੂੰ ਕੁਛ ਕੁੜਤੀਜ਼ ਪਸੰਦ ਆ ਗਈਆਂ ਅਤੇ ਮੈਂ ਮੰਗਵਾ ਲਈਆਂ ਪਰ ਮੈਨੂੰ ਡਰ ਵੀ ਸੀ ਕਿ ਹਾਂ ਭੈੜੀ ਨਿਕਲ ਸਕਦੀ ਹੈ ਕੁਛ ਵੀ ਫਿਰ ਮੈਂ ਸੋਚਿਆ ਚਲੋ ਕੋਈ ਨਹੀਂ ਮੰਗਵਾ ਕੇ ਦੇਖਦੇ ਹਾਂ ਅਤੇ ਮੈਂ ਔਡਰ ਕਰਤੀਆਂ ਅਤੇ ਜਦੋਂ ਉਹ ਔਡਰ ਆਇਆ ਮੇਰੇ ਕੋਲ ਮੈਂ ਰਿਸੀਵ ਕੀਤਾ ਤਾਂ ਮੈਂ ਖੋਲ੍ਹਿਆ ਦੇਖਿਆ ਕਿ ਉਸਾ ਕਲਰ ਹੀ ਹੋਰ ਸੀ ਫਿਰ ਮੈਂ ਕੱਪੜਾ ਚੈੱਕ ਕਰਿਆ ਕੱਪੜਾ ਬਿਲਕੁਲ ਘਟੀਆ ਜਦੋਂ ਮੈਂ ਪਹਿਲੀ ਵਾਰ ਪਾਇਆ ਉਹਦਾ ਕੱਪੜਾ ਬਿਲਕੁਲ ਲੜਨ ਵਾਲਾ ਬਿਲਕੁਲ ਵਧੀਆ ਨਹੀਂ ਅਤੇ ਉਸ ਤੋਂ ਬਾਅਦ ਫਸਟ ਵੋਸ਼ 'ਤੇ ਉਸਦਾ ਕਲਰ ਹੈ ਜਿਹੜਾ ਉਹ ਬਿਲਕੁਲ ਹੀ ਫੇਡ ਹੋ ਗਿਆ ਬਿਲਕੁਲ ਘਟੀਆ ਬਟਨ ਵਗੈਰਾ ਟੁੱਟ ਗਏ ਮੋਤੀ ਵਗੈਰਾ ਵੀ ਨਿਕਲ ਗਏ ਮੇਰਾ ਬਿਲਕੁਲ ਮਤਲਬ ਘਟੀਆ ਐਕਸਪੀਰੀਅੰਸ ਰਿਹਾ ਉੱਥੇ ਫਿਰ ਮੈਂ ਸੋਚਿਆ ਕਿ ਹਾਂ ਹੁਣ ਕੀ ਕਰਾਂ ਪ੍ਰੰਤੂ ਉਥ ਉੱਥੇ ਕੁਛ ਰਿਟਰਨਏਬਲ ਵੀ ਨਹੀਂ ਸੀ ਉਹਨਾਂ ਨੇ ਕਿਹਾ ਹੈ ਕਿ ਰਿਟਰਨ ਨਹੀਂ ਕਰ ਸਕਦੇ ਤੁਸੀਂ ਯੇ ਵੋ